ਬਚਪਨ ਤੋਂ ਸਕੂਲ ਵਿੱਚ ਪੜ੍ਹਦੇ ਹੋਏ ਮੈਨੂੰ ਕਹਾਣੀਆਂ ਨੇ ਬਹੁਤ ਪ੍ਰਭਾਵਿਤ ਕਰਿਆ ਇਸ ਕਰਕੇ ਮੈਨੂੰ ਲਿਖਣ ਦੀ ਬਹੁਤ ਆ ਬਚਪਨ ਤੋਂ ਹੀ ਆਦਤ ਪੈ ਗਈ ਸੀ ਔਰ ਮੈਂ ਲਿਖਦਾ ਸੀ ਔਰ ਮੇਰਾ ਇੱਕ ਮਿੱਤਰ ਮੈਨੂੰ ਮਿਲਿਆ ਜਿਸ ਨੇ ਮੈਨੂੰ ਜਿਸ ਦੀ ਹੱਥ ਲਿਖਤ ਨੇ ਮੈਨੂੰ ਬਹੁਤ ਪ੍ਰਭਾਵਿਤ ਕਰਿਆ ਉਸ ਦੀਆਂ ਲਿਖੀਆਂ ਹੋਈਆਂ ਬਹੁਤ ਕਹਾਣੀਆਂ ਮੈ ਖ਼ੁਦ ਪੜ੍ਹੀਆਂ ਜਿਸ ਨੇ ਮੈਨੂੰ ਲਿਖਣ ਬਾਰੇ ਉਤਸ਼ਾਹਿਤ ਕਰਿਆ ਔਰ ਮੈਨੂੰ ਲਿਖਣਾ ਬਹੁਤ ਚੰਗਾ ਲੱਗਦਾ ਹੈ ਜੀ ਕਿਉਂਕਿ ਆਪਣੇ ਜੀਵਨ ਸ਼ੈਲੀ ਆਪਣੇ ਮਨ ਦੇ ਸਾਰੇ ਉਤਾਰ ਚੜ੍ਹਾਅ ਅਸੀਂ ਲਿਖ ਕੇ ਪੂਰੇ ਕਰ ਸਕਦੇ ਹਾਂ ਜਿਹੜੇ ਕਿ ਸਾਨੂੰ ਆਉਣ ਵਾਲੇ ਸਮੇਂ 'ਚ ਜੀਣ ਦੀ ਸੇਧ ਦਿੰਦੇ ਹਨ